ਪੰਜਾਬ ਵਿੱਚ ਕਣਕ ਦੀ ਕਣਕ ਦੇ ਉਗਾਉਣ ਦਾ ਮਤਲਬ ਇੱਕ ਮੌਸਮ ਅਤੇ ਜਮੀਨ ਬਹੁਤ ਹੀ ਵਧੀਆ ਹੈ ਜੋ ਕਿ ਕਣਕ ਉਗਾਉਣ ਲਈ ਜਿਸ ਤਰ੍ਹਾਂ ਕਿ ਆਪਣੇ ਕਿਸਾਨ ਪਹਿਲੇ ਟਾਈਮ 'ਚ ਚੰਗੀ ਤਰ੍ਹਾਂ ਪੈਲ਼ੀ ਨੂੰ ਵਾਹੁੰਦਾ ਹੈ ਫਿਰ ਉਸਦੇ ਵਿੱਚ ਪਾਣੀ ਪਾਣੀ ਲਗਾਉਂਦਾ ਹੈ ਫਿਰ ਉਸਦੇ ਵਿੱਚ ਕੁਛ ਦਿਨਾਂ ਬਾਅਦ ਉਸਨੂੰ ਕਣਕ ਦਾ ਬੀਜ਼ ਬੀਜ਼ਦਾ ਹੈ ਅਤੇ ਉਸ ਉਸਦੇ ਉੱਤੇ ਕਈ ਤਰ੍ਹਾਂ ਦੇ ਕੈਮੀਕਲ ਪ ਪਾਉਂਦਾ ਹੈ ਕਿ ਜਿਹੜੀ ਉਹਦੀ ਕਣਕ ਵਧੀਆ ਤੋਂ ਵਧੀਆ ਹੋਵੇ ਛੇਤੀ ਤੋਂ ਛੇਤੀ ਹੋਵੇ ਜਿਹੜਾ ਕਿ ਕਣਕ ਵੱਢਣ ਦਾ ਹੈਗਾ ਹੈ ਉਹ ਹੈਗਾ ਆਪਣੇ ਗਰਮੀਆਂ 'ਚ ਵੱਢੀ ਵੱਢੀ ਜਾਂਦੀ ਹੈ ਇਹ ਵਿਸਾਖੀ ਦੇ ਲਾਗੇ ਛਾਗੇ ਵੱਢੀ ਜਾਂਦੀ ਹੈ ਕਿਉਂਕਿ ਉਹ ਮਹੀਨਾ ਕਣਕ ਵੱਢਣ ਦਾ ਹੁੰਦਾ ਹੈ ਅਤੇ ਕਿਸਾਨ ਉਸਨੂੰ ਚੰਗੀ ਪੁੱਤਾਂ ਵਾਂਗੂੰ ਪਾਲ ਕੇ ਅਪ੍ਰੈਲ ਅਪ੍ਰੈਲ ਮਹੀਨੇ 'ਚ ਕਣਕ ਵੱਢਦਾ ਹੈ ਅਤੇ ਉਸਨੂੰ ਬ ਮੰਡੀ 'ਚ ਵੇਚਦਾ ਹੈ